ਮੈਂ ਫਲਿਪਕਾਰਟ ਤੋਂ ਇੱਕ ਏਅਰਰਿੰਗਸ ਦਾ ਜੋੜਾ ਖਰੀਦਿਆ ਸੀਗਾ ਅਤੇ ਉਹ ਜਦੋਂ ਮੇਰੇ ਕੋਲ ਆਇਆ ਤਾਂ ਜਿੱਦਾਂ ਦਾ ਮੈਂ ਉਹਨੂੰ ਪਿਕਚਰ 'ਤੇ ਦੇਖਿਆ ਸੀਗਾ ਐਸ ਏ ਟੀਜ਼ ਸੇਮ ਉੱਦਾਂ ਦਾ ਹੀ ਕਲਰ ਸੀਗਾ ਉਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਸੀਗਾ ਦੇਖਣ ਨੂੰ ਅਤੇ ਉਹਨਾਂ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਸੀ ਕਲਰ ਵੀ ਐਜ਼ ਏ ਬਿਲਕੁਲ ਪਿਕਚਰ ਦੇ ਨਾਲ ਮੈ ਮੇਚ ਹੋ ਰਿਹਾ ਸੀਗਾ ਜਿੱਦਾਂ ਦੀ ਮੈਂ ਪਿਕਚਰ ਦੇਖੀ ਸੀਗੀ ਸੇਮ ਉਹਨਾਂ ਦੀ ਕੁਆਲਿਟੀ ਇੰਨੀ ਜ਼ਿਆਦਾ ਸੋਹਣੀ ਸੀ ਅਤੇ ਮੈਂ ਜਦੋਂ ਪਾ ਕੇ ਉਹਨੂੰ ਵਿਆਹ 'ਤੇ ਗਈ ਹੈ ਨਾ ਮੇਰੀਆਂ ਸਾਰੀਆਂ ਫਰੈਂਡਜ਼ ਮੈਨੂੰ ਪੁੱਛ ਰਹੀਆਂ ਸੀਗੀਆ ਵੀ ਤੂੰ ਏਅਰਰਿੰਗਸ ਕਿੱਥੋਂ ਲਏ ਆ ਮੈਨੂੰ ਬੜਾ ਜ਼ਿਆਦਾ ਵਧੀਆ ਫੀਲ ਹੋਇਆ ਅਤੇ ਉਹਨਾਂ ਦੀ ਕੁਆਲਿਟੀ ਅਤੇ ਉਹਦੇ ਅ ਕਲਰ ਬਹੁਤ ਜ਼ਿਆਦਾ ਸੋਹਣਾ ਸੀਗਾ